ਖੇਡਾਂ ਸਾਡੇ ਜੀਵਨ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ ਖੇਡਾਂ ਸਾਡੇ ਜੀਵਨ ਵਿੱਚ ਬਹੁਤ ਹੀ ਖੁਸ਼ੀਆਂ ਲਿਆਉਂਦੀਆਂ ਹਨ ਖੇਡਾਂ ਜਿਵੇਂ ਕਿ ਬਾਸਕਿਟਬਾਲ ਕ੍ਰਿਕਟ ਹਾਕੀ ਫੁੱਟਬਾਲ ਜਿਮਨਾਸਟਿਕ ਬਾਸਕਿਟਬਾਲ ਖੋ ਖੋ ਆਦਿ ਗੇਮਾਂ ਖੇਡੀਆਂ ਜਾਂਦੀਆ ਹਨ ਜਿਵੇਂ ਸਾਡੇ ਪੇਂਡੂ ਪਿੰਡਾਂ ਵਿੱਚ ਕਬੱਡੀ ਕੁਸ਼ਤੀ ਹਾਕੀ ਜਿਮਨਾਸਟਿਕ ਵਗੈਰਾ ਆਦਿ ਖੇਡੀਆਂ ਜਾਂਦੀਆਂ ਹਨ ਅਤੇ ਉਹਨਾਂ ਵਿੱਚ ਖੇਡਣ ਸਮੇਂ ਬਹੁਤ ਜ਼ਿਆਦਾ ਸੱਟਾਂ ਵੀ ਲੱਗਦੀਆਂ ਹਨ ਜਿਹਨਾਂ ਨੂੰ ਖਿਡਾਰੀਆਂ ਨੂੰ ਸੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਗੋਡਿਆਂ ਦੀ ਸੱਟ ਕੂਹਣੀ ਦੀ ਸੱਟ ਅਤੇ ਹੋਰ ਬਹੁਤ ਸੱਟਾਂ ਲੱਗਦੀਆਂ ਹਨ ਅਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਬਹੁਤ ਜ਼ਿਆਦਾ ਸਹੂਲਤਾਂ ਹਨ ਜਿਵੇਂ ਕਿ ਫਸਟ ਏਡ ਪੱਟੀਆਂ ਇੰਜੈਕਸ਼ਨ ਵਗੈਰਾ ਆਦਿ ਸਾਡੇ ਕੋਲ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਕਿ ਜੋ ਪਲੇਅਰ ਠੀਕ ਹੋ ਕੇ ਖੇਡ ਸਕੇ ਖੇਡਾਂ ਬਹੁਤ ਹੀ ਮਹੱਤਵਪੂਰਨ ਸਾਧਨ ਹੈ ਜੀਵਨ ਦਾ ਖੇਡਾਂ ਨਾਲ ਬਹੁਤ ਹੀ ਜ਼ਿਆਦਾ ਜੀਵਨ ਵਿੱਚ ਖੁਸ਼ੀ ਮਾਨਸਿਕਤਾ ਦਿਮਾਗ ਆਦਿ ਦਾ ਵਿਕਾਸ ਹੁੰਦਾ ਹੈ ਖੇਡਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਸਰੀਰ ਵਾਸਤੇ ਖੇਡਾਂ ਸਾਨੂੰ ਹਰ ਰੋਜ਼ ਸਵੇਰੇ ਸ਼ਾਮ ਸਰੀਰ ਨੂੰ ਸੈੱਟ ਕਰਨ ਵਾਸਤੇ ਖੇਡੀਆਂ ਜਾਣੀਆਂ ਚਾਹੀਦੀਆਂ ਹਨ ਸਰੀਰ ਦਾ ਬਹੁਤ ਹੀ ਵਧੀਆ ਕਸਰਤ ਕਰਨ ਨਾਲ ਸਰੀਰ ਨੂੰ ਤੰਦਰੁਸਤੀ ਦਿਮਾਗ ਦੀ ਸ਼ਕਤੀ ਦਾ ਵਾਧਾ ਹੁੰਦਾ ਹੈ ਖੇਡਾਂ ਜਿਵੇਂ ਕਿ ਹਾਕੀ ਫੁੱਟਬਾਲ ਸਾਨੂੰ ਹਰ ਰੋਜ਼ ਖੇਡਣੀਆਂ ਚਾਹੀਦੀਆਂ ਹਨ ਗਰਾਊਂਡ ਸਵੇਰੇ ਸ਼ਾਮ ਜਾਣਾ ਚਾਹੀਦਾ ਹੈ ਤਾਂ ਜੋ ਸਾਡਾ ਸਰੀਰ ਮਾਨਸਿਕਤਾ ਸੰਤੁਲਨ ਬਣਾਈ ਰੱਖੇ ਸਰੀਰ ਨੂੰ ਸੈੱਟ ਕਰਨ ਲਈ ਮਾਨਸਿਕਤਾ ਵਧਾਉਣ ਲਈ ਸਾਨੂੰ ਹਰ ਰੋਜ਼ ਸਵੇਰੇ ਸ਼ਾਮ ਗਰਾਉਂਡ ਜਾਣਾ ਚਾਹੀਦਾ ਹੈ ਵੱਧ ਤੋਂ ਵੱਧ ਭੱਜਣਾ ਚਾਹੀਦਾ ਹੈ ਗੇਮਾਂ ਖੇਡਣੀਆਂ ਚਾਹੀਦੀਆਂ ਹਨ ਕ੍ਰਿਕਟ ਹਾਕੀ ਫੁੱਟਬਾਲ ਜਿਮਨਾਸਟਿਕ ਸਾਨੂੰ ਹਰ ਰੋਜ਼ ਕੁਝ ਨਾ ਕੁਝ ਯੋਗਾ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਸਰੀਰ ਵੱਧਦਾ ਫੁੱਲਦਾ ਰਹੇ ਅਤੇ ਬਿਮਾਰੀਆਂ ਤੋਂ ਦੂਰ ਰਹੇ ਸਾਨੂੰ ਹਰ ਰੋਜ਼ ਗਰਾਊਂਡ ਵਿੱਚ ਪੰਜ ਤੋਂ ਸੱਤ ਮਿੰਟ ਭੱਜਣਾ ਚਾਹੀਦਾ ਹੈ ਤਾਂ ਜੋ ਸਾਡੇ ਸਰੀਰ ਦਾ ਪਸੀਨਾ ਨਿਕਲ ਸਕੇ ਅਤੇ ਸਾਡੇ ਸਰੀਰ ਦੇ ਰੋਮ ਰੋਮ ਖੁੱਲ੍ਹ ਸਕਣ ਅਤੇ ਪਸੀਨਾ ਬਾਹਰ ਆ ਸਕੇ ਤਾਂ ਸਾ ਅਸੀਂ ਬਿਮਾਰੀਆਂ ਤੋਂ ਬਚ ਬੱਚਤ ਕਰ ਸਕੀਏ ਸਰੀਰ ਨੂੰ ਹਰ ਰੋਜ਼ ਦਸ ਤੋਂ ਪੰਦਰ੍ਹਾਂ ਮਿੰਟ ਦੀ ਵਰਜਿਸ਼ ਕਰਨੀ ਚਾਹੀਦੀ ਹੈ ਤਾਂ ਜੋ ਸਰੀਰ ਬਿਮਾਰੀਆਂ ਤੋਂ ਮੁਕਤ ਰਹੇ ਬਿਮਾਰੀਆਂ ਤੋਂ ਦੂਰ ਰਹੇ ਹਰ ਰੋਜ਼ ਸਾਨੂੰ ਕੋਈ ਨਾ ਕੋਈ ਨਵੀਂ ਤੋਂ ਨਵੀਂ ਵਧੀਆ ਤੋਂ ਵਧੀਆ ਗੇਮ ਖੇਡਣੀ ਚਾਹੀਦੀ ਹੈ ਤਾਂ ਜੋ ਸਰੀਰ ਸਾਡਾ ਤੰਦਰੁਸਤ ਬਿਮਾਰੀਆਂ ਤੋਂ ਮੁਕਤ ਰਹੇ ਹਾਂਜੀ